ਪੰਜਾਬੀ ਪਰਿਵਾਰ ਵਿੱਚ ਬੱਚਾ ਪੈਦਾ ਹੋਣ 'ਤੇ ਪਹਿਲਾਂ ਗੁੜਤੀ ਦਿੱਤੀ ਜਾਂਦੀ ਹੈ ਫਿਰ ਬੱਚਾ ਜੇ ਮੁੰਡਾ ਹੋਵੇ ਤਾਂ ਗੇਟ ਉੱਤੇ ਰੀਬਨ ਬੰਨ੍ਹਿਆ ਜਾਂਦਾ ਹੈ ਨਿੰਮ ਬੰਨ੍ਹਿਆ ਜਾਂਦਾ ਹੈ ਅਤੇ ਜੇ ਮਤਲਬ ਬੱਚਾ ਨਾਨਕੇ ਪੈਦਾ ਹੋਵੇ ਤਾਂ ਦਾਦਕੇ ਬੱਚੇ ਦੇ ਪੰਜੀਰੀ ਲੈ ਕੇ ਆਉਂਦੇ ਆ ਅਤੇ ਬੱਚੇ ਲਈ ਹੋਰ ਖੇਡਾਂ ਖਿਡੌਣੇ ਲੈ ਕੇ ਆਉਂਦੇ ਆ ਜੇ ਬੱਚਾ ਦਾਦਕੇ ਪੈਦਾ ਹੋਵੇ ਤਾਂ ਨਾਨਕੇ ਬੱਚੇ ਨੂੰ ਸੋਨੇ ਦੀ ਚੈਨੀ ਵਗੈਰਾ ਪਾ ਕੇ ਆਉਂਦੇ ਆ ਅਤੇ ਬੱਚੇ ਦੀ ਮਾਂ ਨੂੰ ਸੋਨੇ ਦੇ ਟੋਕਸ ਵਗੈਰਾ ਪਾਉਂਦੇ ਆ ਅਤੇ ਨਾਲ ਮਠਿਆਈਆਂ ਲੈ ਕੇ ਜਾਂਦੇ ਆ ਅਤੇ ਬੱਚੇ ਦੀ ਪਹਿਲੀ ਲੋਹੜੀ ਵੀ ਬੜੀ ਧੂਮਧਾਮ ਨਾਲ ਮਨਾਈ ਜਾਂਦੀ ਆ ਅਤੇ ਬੱਚੇ ਦਾ ਜਿਹੜਾ ਅੱਠਵਾਂ ਦਿਨ ਹੁੰਦਾ ਉਹ ਅਣਗਿਤ ਦਿਨ ਕਹਿੰਦੇ ਆ ਜਿਹੜਾ ਅਠਾਰਵਾਂ ਦਿਨ ਹੁੰਦਾ ਬੱਚੇ ਦਾ ਉਹਨੂੰ ਵੱਡਾ ਦਿਨ ਕਹਿੰਦੇ ਆ ਸਵਾ ਮਹੀਨੇ ਬਾਅਦ ਬੱਚੇ ਨੂੰ ਬਾਹਰ ਵਧਾਉਂਦੇ ਆ ਅਤੇ ਬੱਚੇ ਦਾ ਜਿਹੜਾ ਨਾਮ ਆ ਉਹ ਗੁਰੂ ਘਰੋਂ ਜਾ ਕੇ ਕਢਵਾਉਂਦੇ ਆ ਬੱਚੇ ਦਾ ਨਾਮ ਰੱਖਿਆ ਜਾਂਦਾ ਗੁਰੂ ਘਰੋਂ ਸ਼ਬਦ ਕਢਾਇਆ ਜਾਂਦਾ ਹੈਗਾ ਮਤਲਬ ਦੋਨੇ ਪਰਿਵਾਰ ਦਾਦਕਾ ਅਤੇ ਨਾਨਕਾ ਪਰਿਵਾਰ ਰਲ ਕੇ ਬੜੀ ਖੁਸ਼ੀ ਖੁਸ਼ੀ ਮਨਾਉਂਦੇ ਆ ਅਤੇ ਦੋਨੇ ਬੱਚੇ ਦੇ ਮਤਲਬ ਇੱਕ ਸਾਲ ਹੋਣ 'ਤੇ ਬੱਚੇ ਦਾ ਬੜੀ ਰਿਸ਼ਤੇਦਾਰਾਂ ਨੂੰ ਸੱਦ ਕੇ ਜਨਮਦਿਨ ਮਨਾਇਆ ਜਾਂਦਾ ਹੈ ਪੰਜਾਬੀ ਪਰਿਵਾਰ ਵਿੱਚ ਜੇ ਕਹੀਏ ਤਾਂ ਛ ਬ ਬੱਚੇ ਦੀ ਪਹਿਲੀ ਛਟੀ ਮਨਾਈ ਜਾਂਦੀ ਹੈ ਅਤੇ ਵਾਲੀ ਬੱਚੇ ਨੂੰ ਮਤਲਬ ਵੀ ਬੱਚਾ ਪੰਜਾਬੀ ਪਰਿਵਾਰ ਵਿੱਚ ਬਹੁਤ ਖੁਸ਼ੀ ਮਨਾਈ ਜਾਂਦੀ ਹੈ